ਮੈਂ ਜਿਹੜੀ ਆਪਣੀ ਮਤਲਬ ਮੂਲ ਭਾਸ਼ਾ ਜਿੱਦਾਂ ਮੇਰੀ ਮੂਲ ਭਾਸ਼ਾ ਪੰਜਾਬੀ ਹੈਗੀ ਹੈ ਇਹ ਤੋਂ ਇਲਾਵਾ ਜਿਹੜੀ ਮੈਂ ਹੋਰ ਵੱਖਰੀ ਇਹਤੇ ਮਤਲਬ ਹੋਰ ਕੋਈ ਲੈਂਗੁਏਜ 'ਚ ਕਿਤਾਬ ਪੜ੍ਹੀ ਹੈਗੀ ਹੈ ਉਹ ਹੈਗੀ ਹੈ ਰਿਚ ਡੈਡ ਪੂਅਰ ਡੈਡ ਉਹ ਮੈਨੂੰ ਕਿਤਾਬ ਬੜੀ ਵਧੀਆ ਲੱਗਦੀ ਹੈਗੀ ਹੈ ਉਸ ਕਿਤਾਬ ਵਿੱਚ ਇਹ ਦੱਸਿਆ ਵਾ ਹੈਗਾ ਹੈ ਵੀ ਜਿੱਦਾਂ ਹੁਣ ਇੱਕ ਇੱਕ ਬੱਚਾ ਹੁੰਦਾ ਹੈਗਾ ਹੈ ਇੱਕ ਉਹਦਾ ਦੋਸਤ ਹੁੰਦਾ ਹੈਗਾ ਉਹਦਾ ਜਿਹੜਾ ਦੋਸਤ ਦਾ ਡੈਡੀ ਹੁੰਦਾ ਉਹ ਕਾਫੀ ਅਮੀਰ ਹੁੰਦਾ ਹੈਗਾ ਅਤੇ ਉਹਦਾ ਬੱਚੇ ਦਾ ਡੈਡੀ ਕਾਫੀ ਗਰੀਬ ਹੁੰਦਾ ਹੈਗਾ ਹੈ ਉਹ ਦੋਨਾਂ ਵਿੱਚ ਐਨਾਲਾਈਜ਼ ਕਰਦਾ ਹੈਗਾ ਦੇਖਦਾ ਹੈਗਾ ਦੋਨਾਂ ਵਿੱਚ ਵੀ ਇਹੀ ਕਿਆ ਚੀਜ਼ ਹੈਗੀ ਹੈ ਵੀ ਜਿਹੜਾ ਮੇਰਾ ਡੈਡੀ ਗਰੀਬ ਹੈਗਾ ਹੈ ਅਤੇ ਮੇਰੇ ਦੋਸਤ ਦਾ ਡੈਡੀ ਅਮੀਰ ਹੈਗਾ ਹੈ ਉਹ ਦੋਨਾਂ 'ਚ ਇਹੀ ਪਤਾ ਕਰਦਾ ਰਹਿੰਦਾ ਹੈਗਾ ਹੈ ਵੀ ਵਈ ਇਹਨਾਂ 'ਚ ਕਿਆ ਚੀਜ਼ਾਂ ਜਿਹੜੀਆਂ ਦੋਸਤ ਦੇ ਡੈਡੀ ਨੂੰ ਅਮੀਰ ਬਣਾਉਂਦੀਆਂ ਅਤੇ ਮੇਰੇ ਡੈਡੀ ਨੂੰ ਗਰੀਬ ਬਣਾਉਂਦੀਆਂ ਹੈਗੀਆਂ ਹੈ ਉਸ ਕਿਤਾਬ 'ਚ ਦੱਸਿਆ ਵਾ ਹੈਗਾ ਹੈ ਵੀ ਜਿੱਦਾਂ ਹੁਣ ਅਸੀਂ ਪੈਸਾ ਹੈ ਪੈਸੇ ਨੂੰ ਆਪਾਂ ਕਿੱਦਾਂ ਖਰਚ ਕਰਨਾ ਹੈਗਾ ਹੈ ਕਿੱਦਾਂ ਉਹਦੀ ਕੀਮਤ ਬਣਾਉਣੀ ਹੈ ਕਿੱਦਾਂ ਪੈਸੇ ਨਾਲ ਪੈਸਾ ਕਮਾਇਆ ਜਾ ਸਕਦਾ ਹੈਗਾ ਹੈ ਇਹ ਸਭ ਚੀਜ਼ਾਂ ਉਸ ਕਿਤਾਬ ਵਿੱਚ ਦੱਸੀਆਂ ਗਈਆਂ ਹੈਗਾ ਇਸ ਕਰਕੇ ਜਿਹੜੀ ਮੇਰੀ ਹੈਗੀ ਹੈ ਰਿਚ ਡੈਡ ਪੂਅਰ ਡੈਡ ਇਹ ਮੈਨੂੰ ਕਿਤਾਬ ਬੜੀ ਵਧੀਆ ਲੱਗਦੀ ਹੈਗੀ ਹੈ ਇਹਤੇ ਇਲਾਵਾ ਜੇ ਮੈਂ ਆਪਣੀ ਮਤਲਬ ਮੂਲ ਭਾਸ਼ਾ ਵਿੱਚ ਜੇ ਕਿਸੇ ਕਿਤਾਬ ਦਾ ਨਾਮ ਲੈਣਾ ਹੈਗਾ ਹੈ ਤਾਂ ਉਹ ਮੈਨੂੰ ਜਿਹੜੀ ਇੱਕ ਰੋਜ਼ਾ ਪਾਰਕਰ ਹੈਗੀ ਹੈ ਉਹਦੀ ਮੈਨੂੰ ਮਤਲਬ ਉਹਦੀ ਜੀਵਨੀ ਮੈਨੂੰ ਬੜੀ ਵਧੀਆ ਲੱਗਦੀ ਹੈਗੀ ਜਿੱਦਾਂ ਹੁਣ ਉੱਨੀ ਸੌ ਜਿਹੜੀ ਹੈ ਸੱਠ ਸੁੱਠ ਦੇ ਦਸ਼ਕ ਵਿੱਚ ਇੱਕ ਰੋਜ਼ਾ ਪਾਰਕਰ ਹੋਈ ਹੈਗੀ ਹੈ ਅਮਰੀਕਾ ਦੀ ਲੇਡੀ ਸੀਗੀ ਇਹਨੇ ਨਾ ਜਿੱਦਾਂ ਹੁਣ ਉੱਥੇ ਸੀਗਾ ਸ਼ਵੇਤ ਸ਼ਵੇਤ ਆਲਾ ਝਗੜਾ ਚਲਦਾ ਸੀਗਾ ਵੀ ਜਿੱਦਾਂ ਹੁਣ ਮੰਨ ਲਓ ਪਹਿਲੀਆਂ ਚਾਰ ਕੁਰਸੀਆਂ ਹੈ ਕਿਸੇ ਬੱਸ ਦੇ ਵਿੱਚ ਉਹ ਸ਼ਵੇਤ ਸਵੇ ਸ਼ਵੇਤ ਬੰਦਿਆਂ ਵਾਸਤੇ ਹੁੰਦੀਆਂ ਸੀਗੀਆਂ ਜਿਹੜੀਆਂ ਅਗਲੀ ਪੰਜਵੀਂ ਕੁਰਸੀ 'ਤੇ ਸ਼ਵੇਤ ਨਹੀਂ ਬੈਠ ਸਕਦਾ ਸੀਗਾ ਇਹਨੂੰ ਜਿਹੜੀ ਹੈ ਪੰਜਵੀਂ ਕੁਰਸੀ 'ਤੇ ਬੈਠੀ ਸੀਗੀ ਇਹਨੂੰ ਉਠਾਲਿਆ ਗਿਆ ਇਹ ਉੱਠੀ ਨਹੀਂ ਹੈਗੀ ਹੈ ਇਹਦੇ ਕਰਕੇ ਇਹਨੂੰ ਦੰਡ ਵੀ ਦਿੱਤਾ ਗਿਆ ਇਹਨੇ ਹੜਤਾਲ ਕਰ ਦਿੱਤੀ ਸ਼ਵੇਤ ਬੰਦਿਆਂ ਨੇ ਹੜਤਾਲ ਕਰ ਦਿੱਤੀ ਹੈਗੀ ਹੈ ਅਤੇ ਹੜਤਾਲ ਕਰਨ ਤੋਂ ਬਾਅਦ ਤਿੰਨ ਸੌ ਸੱਠ ਦਿਨ ਤੱਕ ਹੜਤਾਲ ਚੱਲੀ ਹੈਗੀ ਹੈ ਇਹਨਾਂ ਨੇ ਕਿੱਦਾਂ ਹੱਕ ਲਏ ਕਿੱਦਾਂ ਸ਼ਵੇਤ ਦੇ ਬਰਾਬਰ ਰਹੇ ਹੈਗੇ ਹੈ ਜਿਹੜੇ ਸ਼ਵੇਤ ਹੈਗੇ ਹੈ ਇਸ ਕਰਕੇ ਮੈਨੂੰ ਜਿਹੜੀ ਰੋਜ਼ਾ ਪਾਰਕਰ ਦੀ ਜੀਵਨੀ ਹੈਗੀ ਜਾਂ ਰੋਜ਼ਾ ਪਾਰਕਰ ਇਹ ਮੈਨੂੰ ਪੂਰੀ ਦੁਨੀਆਂ ਵਿੱਚ ਹਰ ਕਿਸੇ ਨੂੰ ਪੜ੍ਹਨੀ ਚਾਹੀਦੀ ਹੈਗੀ ਹੈ ਵੀ ਇਹਨਾਂ ਨੇ ਕਿੱਦਾਂ ਜਿਹੜੇ ਬਰਾਬਰ ਆਏ ਹੈਗੇ ਹੈ ਇਹ